ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਮੁੱਖ ਸੱਭਿਆਚਾਰਕ ਤਿਉਹਾਰ ਮਨਾਏ ਜਾਂਦੇ ਹਨ ਇਹਨਾਂ ਤਿਉਹਾਰਾਂ ਦੀ ਆਪਣੀ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਹਨ ਜਿਵੇਂ ਕਿ ਦੀਵਾਲੀ ਇੱਕ ਬਹੁਤ ਵੱਡਾ ਤਿਉਹਾਰ ਹੈ ਇਸ ਦਿਨ ਸਾਰੇ ਲੋਕ ਆਪਣੇ ਘਰਾਂ ਵਿੱਚ ਦੀਵੇ ਜਲਾਉਂਦੇ ਹਨ ਅਤੇ ਬੱਚੇ ਪਟਾਖਿਆਂ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ ਅਤੇ ਮਠਿਆਈਆਂ ਖਾਂਦੇ ਹਨ ਇਸ ਤਰ੍ਹਾਂ ਇਹ ਤਿਉਹਾਰ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ ਦੁਸਹਿਰਾ ਦੁਸਹਿਰਾ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਇਸ ਇਸ ਦਿਨ ਵੀ ਲੋਕ ਆਪਣੇ ਘਰਾਂ ਵਿੱਚ ਦੀਵੇ ਜਲਾਉਂਦੇ ਹਨ ਅਤੇ ਇਸ ਦਿਨ ਬੁਰਾਈ 'ਤੇ ਅੱਛਾਈ ਦੀ ਜਿੱਤ ਹੋਈ ਸੀ ਇਸ ਦਿਨ ਰਾਵਣ ਦੇ ਪੁਤਲੇ ਨੂੰ ਸਾੜਿਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਇਹ ਤਿਉਹਾਰ ਵੀ ਬਹੁਤ ਲੋਕ ਪਿਆਰਾ ਹੈ ਵਿਸਾਖੀ ਵਿਸਾਖੀ ਕਿਸਾਨਾਂ ਦਾ ਇੱਕ ਮੁੱਖ ਤਿਉਹਾਰ ਹੈ ਇਸ ਦਿਨ ਇਸ ਦਿਨ ਕਿਸਾਨ ਆਪਣੇ ਖੇਤਾਂ ਵਿੱਚ ਵਾਢੀ ਕਰਦੇ ਹਨ ਅਤੇ ਦਾਣਿਆਂ ਨੂੰ ਘਰ ਵਿੱਚ ਲੈ ਕੇ ਆਉਂਦੇ ਹਨ ਇਹ ਤਿਉਹਾਰ ਨੂੰ ਭੰਗੜਿਆਂ ਨਾਲ ਭੰਗੜੇ ਪਾ ਕੇ ਮਨਾਇਆ ਜਾਂਦਾ ਹੈ ਅਤੇ ਕਿਸਾਨ ਆਪਣੇ ਗੁਰਦੁਆਰੇ ਜਾਂਦੇ ਹਨ ਮੱਥਾ ਟੇਕਦੇ ਹਨ ਇਸੇ ਤਰ੍ਹਾਂ ਇਹ ਤਿਉਹਾਰ ਵੀ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ ਹੋਲੀ ਹੋਲੀ ਇੱਕ ਰੰਗਾਂ ਦਾ ਤਿਉਹਾਰ ਹੈ ਇਸ ਇਸ ਵਿੱਚ ਲੋਕ ਇੱਕ ਦੂਜੇ ਦੇ ਰੰਗ ਲਗਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ ਮਠਿਆਈਆਂ ਖਾਂਦੇ ਹਨ ਅਤੇ ਇਸੇ ਤਰ੍ਹਾਂ ਇਹ ਤਿਉਹਾਰ ਵੀ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ